ਡਾਂਸ ਮੇਰਾ ਕਰੀਅਰ ਨਹੀਂ ਸਿਰਫ ਮੇਰਾ ਸ਼ੌਂਕ ਹੈ ਪਰ ਹਾਂ ਮੈਂ ਇਹਨਾਂ ਕੁ ਵਧੀਆ ਡਾਂਸ ਕਰਦੀ ਹਾਂ ਕਿ ਮੈਂ ਇਹਨੂੰ ਆਪਣਾ ਕਰੀਅਰ ਵੀ ਬਣਾ ਸਕਦੀ ਹਾਂ ਪਰ ਇਹ ਵੀ ਸੌਖਾ ਨਹੀਂ ਕਿਉਂਕਿ ਇਸ ਵਿੱਚ ਵੀ ਬਹੁਤ ਰੁਕਾਵਟਾਂ ਨੇ ਜਿਵੇਂ ਕਿ ਮੈਂ ਪੰਜਾਬ ਤੋਂ ਬਿਲੋਂਗ ਕਰਦੀ ਹਾਂ ਪੰਜਾਬ ਵਿੱਚ ਰਹਿੰਦੀ ਹਾਂ ਤਾਂ ਸਾਡੇ ਜਿਵੇਂ ਸਭ ਤੋਂ ਪਹਿਲਾਂ ਤਾਂ ਰਿਸ਼ਤੇਦਾਰ ਹੀ ਲਾ ਲਉ ਇਹਨੂੰ ਕੋਈ ਕੰਮ ਨਹੀਂ ਮੰਨਦੇ ਉਹਨਾਂ ਦਾ ਮੰਨਣਾ ਹੈ ਕਿ ਸਿਰਫ ਇਹ ਕੁੱਤੇ ਖਾਣੀ ਹੈ ਇਹ 'ਚ ਕੋਈ ਇੱਜ਼ਤ ਨਹੀਂ ਹੈਗੀ ਉਹਨਾਂ ਦੇ ਮੰਨਣਾ ਇਹ ਹੈ ਕਿ ਮਤਲਬ ਇਸ 'ਚ ਕੋਈ ਕਰੀਅਰ ਜਾਂ ਕੋਈ ਜਿਵੇਂ ਆਪਾਂ ਕਹਿ ਸਕਦੇ ਹਾਂ ਅੱਗੇ ਕਿਸ ਅੱਗੇ ਵਧਣ ਦਾ ਕੋਈ ਚਾਂਸ ਨਹੀਂ ਬਟ ਮੈਨੂੰ ਲੱਗਦਾ ਕਿ ਡਾਂਸ ਜਾਂ ਡਾਂਸਿੰਗ ਹੀ ਇੱਕ ਇਹ ਜਾ ਪਲੈਟਫੋਮ ਹੈ ਕਿਉਂਕਿ ਇੱਕ ਤਾਂ ਓਹ ਮੇਰਾ ਸ਼ੌਂਕ ਹੈ ਅਤੇ ਉਹ ਦੂਜਾ ਮੈਂ ਉਹਨੂੰ ਵਧੀਆ ਤਰੀਕੇ ਨਾਲ ਕਰ ਸਕਦੀ ਹਾਂ ਤਾਂ ਮੈਂ ਇਹਨੂੰ ਅਪਣਾ ਕਰੀਅਰ ਬਣਾ ਸਕਦੀ ਹਾਂ ਬਟ ਲੋਕਾਂ ਨੂੰ ਹਰੇਕ ਕੋਈ ਇਹ ਗੱਲ ਨਹੀਂ ਸਮਝ ਸਕਦਾ ਲੋਕ ਸੋਚਦੇ ਨੇ ਵੀ ਇਹ ਤਾਂ ਇਹੀ ਕੰਮ ਨੇ ਅਤੇ ਜ਼ਿਆਦਾਤਰ ਇਹ ਪੰਜਾਬ ਹਰਿਆਣੇ 'ਚ ਹੁੰਦਾ ਏ ਕਿ ਮਤਲਬ ਲੋਕ ਸੋਚਦੇ ਨੇ ਕਿ ਇਹ ਇੱਦਾਂ ਦਾ ਹੀ ਕੰਮ ਹੈ ਇਹ 'ਚ ਇੱਜ਼ਤ ਨਹੀਂ ਹੈਗੀ ਬਟ ਨਹੀਂ ਜੇ ਤੁਸੀਂ ਇਹਨੂੰ ਵਧੀਆ ਤਰੀਕੇ ਨਾਲ ਪੇਸ਼ ਕਰੋ ਇਹ 'ਚ ਵੀ ਬਹੁਤ ਇੱਜ਼ਤ ਹੈ ਅਤੇ ਤੁਸੀਂ ਮਤਲਬ ਆਪਣਾ ਕਰੀਅਰ ਬਹੁਤ ਵਧੀਆ ਬਣਾ ਸਕਦੇ ਹੋ ਅਤੇ ਇੱਕ ਵੱਡੇ ਮੁਕਾਮ 'ਤੇ ਪਹੁੰਚ ਸਕਦੇ ਹੋ